ਆਵਾਜਾਈ ਚੱਲਣ ਨਾਲ ਸਾਨੂੰ ਕਾਫੀ ਫਾਇਦਾ ਹੋਇਆ ਹੈਗਾ ਇਸ ਕਾਫੀ ਚੇਂਜ ਹੋ ਗਿਆ ਪਹਿਲਾਂ ਜਿਹੜੀ ਬਿਲਕੁਲ ਆਵਾਜਾਈ ਨਹੀਂ ਸੀਗੀ ਪਹਿਲਾਂ ਸਾਈਕਲ ਗੱਡੇ ਜਾਂ ਪੈਦਲ ਜਾਣਾ ਪੈਂਦਾ ਸੀ ਜੀ ਜੋ ਕਾਫੀ ਜਾਂ ਪਹੁੰਚਣ ਵਿੱਚ ਕਾਫੀ ਟਾਈਮ ਲੱਗਦਾ ਸੀ ਅੱਜ ਕੱਲ੍ਹ ਆਵਾਜਾਈ ਇੰਨੀ ਹੋ ਗਈ ਜੀ ਫਲਾਈਟਾਂ ਚੱਲ ਪਈਆਂ ਬੱਸਾਂ ਚੱਲ ਪਈਆਂ ਕਾਰਾਂ ਚੱਲ ਪਈਆਂ ਬਾਈਕਸ ਚੱਲ ਪਏ ਮੋਟਰਸਾਇਕਲ ਚੱਲ ਪਏ ਅਤੇ ਸਾਨੂੰ ਹੁਣ ਇੱਕ ਦੂਜੀ ਥਾਂ 'ਤੇ ਪਹੁੰਚਣਾ ਬਹੁਤ ਘੱਟ ਸਮਾਂ ਲੱਗਦਾ ਸਾਡਾ ਕਾਫੀ ਸਮਾਂ ਬੱਚ ਗਿਆ ਹੈਗਾ ਅਤੇ ਹੁਣ ਅਸੀਂ ਅਸੀਂ ਬੜੀ ਜਲਦੀ ਇੱਕ ਜਗ੍ਹਾ ਤੋਂ ਦੂਜੀ ਪਹੁੰਚ ਜਾਂਦੇ ਆ ਫਲਾਈਟਾਂ ਰਾਹੀਂ ਅਸੀਂ ਇੱਕ ਕੰਟਰੀ ਦੂਜੀ ਕੰਟਰੀ ਦੇ ਥਰੂ ਹੀ ਬੜੀ ਘੱਟ ਸਮੇਂ 'ਚ ਚਲੇ ਜਾਂਦੇ ਆ ਆਵਾਜਾਈ ਚੱਲਣ ਨਾਲ ਲੋਕਾਂ ਦਾ ਟਾਈਮ ਬੱਚ ਗਿਆ ਅਤੇ ਬਿਜਨਸ ਕਰਨਾ ਸੌਖਾ ਹੋ ਗਿਆ ਅੱਗੇ ਸਾਨੂੰ ਕੋਈ ਵੀ ਸਮਾਨ ਮੰਗਾਉਣਾ ਸੀਗਾ ਤਾਂ ਟਾਈਮ ਲੱਗਦਾ ਬਾਹਰੋਂ ਕੋਈ ਚੀਜ਼ ਆਉਣੀ ਸੀ ਹੁਣ ਫਲਾਈਟਾਂ ਰਾਹੀਂ ਜਲਦੀ ਪਹੁੰਚ ਜਾਂਦੀ ਆ ਅਤੇ ਪਹਿਲਾਂ ਇਹ ਇਹੋ ਜਿਹੀ ਕੋਈ ਸਰਵਿਸ ਨਹੀਂ ਸੀਗੀ ਅਤੇ ਹੁਣ ਫਲਾਈਟਾਂ ਵਗੈਰਾ ਚੱਲਣ ਨਾਲ ਕਾਫੀ ਸ ਸਾਡਾ ਵਪਾਰ ਵੱਧ ਗਿਆ ਦੂਜੇ ਕੰਟਰੀਆਂ ਨਾਲ ਅਤੇ ਬਾਕੀ ਹੁਣ ਅਸੀਂ ਕਾਰਾਂ ਵਿੱਚ ਅੱਗੇ ਸਾਨੂੰ ਇੱਕ ਇੱਕ ਸਾਈਕਲ 'ਤੇ ਇੱਕ ਜਾਂ ਵੱਧ ਤੋਂ ਵੱਧ ਦੋ ਬੰਦੇ ਬੈਠ ਸਕਦੇ ਹੁਣ ਅਸੀਂ ਕਾਰ ਦੇ ਵਿੱਚ ਪੰਜ ਜਣੇ ਬਹਿ ਕੇ ਇਕੱਠੇ ਜਾ ਸਕਦੇ ਹਾਂ ਇੱਕੋ ਜਗ੍ਹਾ ਸਫਰ ਕਰ ਸਕਦੇ ਹਾਂ ਆਵਾਜਾਈ ਨਾਲ ਬਹੁਤ ਹੀ ਮਤਲਬ ਸਹੂਲਤ ਮਿਲੀ ਹੈ ਸਾਨੂੰ ਸਾਡਾ ਟਾਇਮ ਬਚਿਆ ਗਾ ਸਾਡਾ ਬਿਜ਼ਨਸ ਵਧਿਆ ਗਾ ਸਾਡਾ ਆਉਣ ਜਾਣ ਦਾ ਸਿਸਟਮ ਜੋ ਸਾਰਾ ਹੀ ਚੇਂਜ ਹੋ ਗਿਆ ਗਾ ਆਵਾਜਾਈ ਬਹੁਤ ਵਧੀਆ ਗੱਲ ਹੈ